ਸਵਿਟੀ ਟਰੈਵਲ ਏਜੰਸਿਸ ਤੋਂ ਬੋਲ ਰਹੇ ਹੋ ਹਾਂਜੀ ਵੀਰੇ ਮੈਂ ਨਾ ਇੱਥੇ ਹੁਣੇ ਆਈ ਸੀਗੀ ਆਸਟ੍ਰੇਲੀਆ ਤੋਂ ਅਸੀਂ ਮੇਰੇ ਦਾਦਕੇ ਹੁਣੀ ਰਹਿੰਦੇ ਹੁੰਦੇ ਸੀ ਪਟਿਆਲਾ ਅਸੀਂ ਦੋ ਕੁ ਮਹੀਨੇ ਦੀਆਂ ਛੁੱਟੀਆਂ ਬਿਤਾਉਣ ਆਏ ਹਾਂ ਹੁਣੇ ਹੁਣੇ ਜਸਟ ਇੰਡੀਆ ਪੰਜਾਬ ਦੇ ਵਿੱਚ ਹੁਣ ਤੱਕ ਤਾਂ ਵੈਸੇ ਬਹੁਤਾ ਐਕਸਪਲੋਰ ਨਹੀਂ ਕਰਿਆ ਪਰ ਜਿੰਨਾ ਕਰਿਆ ਬਹੁਤ ਵਧੀਆ ਲੱਗ ਰਿਹਾ ਅਤੇ ਮੇਰੇ ਇੱਕ ਫਰੈਂਡ ਨੇ ਮੈਨੂੰ ਨੰਬਰ ਦਿੱਤਾ ਸੀ ਤੁਹਾਡੀ ਏਜੰਸੀ ਦਾ ਮੈਂ ਨਾ ਪੁੱਛਣਾ ਸੀ ਵੀ ਪਟਿਆਲੇ 'ਚ ਕਿਹੜੇ ਕਿਹੜੇ ਪਹਿਲੇ ਤਾਂ ਆ ਜਿਹੜੇ ਨੇ ਰਿਲੀਜ਼ੀਅਸ ਸਾਈਟਸ ਨੇ ਜਿੱਥੇ ਅਸੀਂ ਜਾ ਸਕਦੇ ਹਾਂ ਮੱਥਾ ਮੁੱਥਾ ਟੇਕਣ

ਅੱਛਾ ਅਤੇ ਆਪਣਾ ਕੀ ਕਹਿੰਦੇ ਨੇ ਉਰੇ ਮਤਲਬ ਜਿਵੇਂ ਲੋਕਲ ਫੂਡ ਵਗੈਰਾ ਹੈਗਾ ਤਾਂ ਉਹ ਬੈਸਟ ਜਿਵੇਂ ਭਟੂਰੇ ਛੋਲੇ ਬੱਚਿਆਂ ਨੂੰ ਖੁਆਉਣੇ ਹੋਣ ਜਾਂ ਕੁਛ ਮਤਲਬ ਫੇਮਸ ਹੋਵੇ ਪਟਿਆਲੇ ਦਾ ਥੋੜ੍ਹਾ ਜਿਹਾ ਕਿਹੜਾ ਗੇਟ ਵੀਰੇ ਅੱਛਾ ਸ਼ੇਰਾਂ ਵਾਲਾ ਗੇਟ ਓਕੇ

ਅਤੇ ਜੇ ਅਸੀਂ ਤੁਹਾਡੀ ਕੰਪਨੀ ਵਿੱਚੋਂ ਕੋਈ ਬੰਦਾ ਐਜ ਆ ਗਾਈਡ ਥੋੜ੍ਹੇ ਦਿਨਾਂ ਵਾਸਤੇ ਲੈਣਾ ਹੋਵੇ ਮਤਲਬ ਮਤਲਬ ਜਿਹੜਾ ਸਾਡੇ ਨਾਲ਼ ਥੋੜ੍ਹਾ ਥੋੜ੍ਹੀ ਦੇਰ ਰਹੇ ਅਤੇ ਸਾਨੂੰ ਦੱਸ ਦਿਆ ਕਰੇ ਮਤਲਬ ਪੂਰਾ ਦਿਨ ਜਿਵੇਂ ਫੋਨ 'ਤੇ ਤਾਂ ਹੁਣ ਬੰਦਾ ਨਹੀਂ ਪੁੱਛ ਸਕਦਾ ਵਾਰ ਵਾਰ ਅਤੇ ਉਹਦੇ ਵਿੱਚ ਪੈਕੇਜ਼ ਹੁੰਦਾ ਹੈ ਮੰਥਲੀ ਸਿਸਟਮ ਹੁੰਦਾ ਹੈ ਕਿ ਡੇ ਡੇ ਦਾ ਹੁੰਦਾ ਹੈ ਠੀਕ ਹੈ ਚਲੋ ਥੈਂਕ ਯੂ ਸੋ ਮਚ